ਜਲ ਅਥਾਰਟੀ ਨਾਲ ਬਿਲਿੰਗ ਜਾਣਕਾਰੀ ਨੂੰ ਅਪਡੇਟ ਕਰਨ ਅਤੇ ਭਵਿੱਖ ਦੇ ਬਿੱਲਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਨੂੰ ਯਕੀਨੀ ਬਣਾਉਣ ਲਈ ਮੈਂ ਉਹਨਾਂ ਦੇ ਗਾਹਕ ਸੇਵਾ ਵਿਭਾਗ ਨਾਲ ਸੰਪਰਕ ਕਰਕੇ ਸ਼ੁਰੂਆਤ ਕਰਾਂਗਾ ਜਿਵੇਂ ਕੀ ਫੋਨ ਈਮੇਲ ਜਾਂ ਉਹਨਾਂ ਦੀ ਵੈਬਸਾਈਟ ਜ਼ਿਆਦਾਤਰ ਪਾਣੀ ਉਪਯੋਗਤਾਵਾਂ ਕੋਲ ਸ ਸਮਰਪਿਤ ਗਾਹਕ ਸੇਵਾ ਟੀਮਾਂ ਹੁੰਦੀਆਂ ਹਨ ਜੋ ਬਿਲਿੰਗ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ ਗਾਹਕ ਸੇਵਾ ਨਾਲ ਸੰਪਰਕ ਕਰਦੇ ਸਮੇਂ ਮੈਂ ਸਹੀ ਬਿਲਿੰਗ ਨੂੰ ਯਕੀਨੀ ਬਣਾਉਣ ਲਈ ਜਾਣਕਾਰੀ ਪ੍ਰਦਾਨ ਕਰਾਂਗਾ ਨਿੱਜੀ ਪਛਾਣ ਮੈਂ ਆਪਣੀ ਜਾਣ ਪਛਾਣ ਕਰਵਾਵਾਂਗਾ ਇਹ ਦੱਸਦੇ ਹੋਏ ਕਿ ਮੈਂ ਪ੍ਰਸ਼ਨ ਅਧੀਨ ਜਾਇਦਾਦ ਦਾ ਮੌਜੂਦਾ ਨਿਵਾਸੀ ਹਾਂ ਜ਼ਿਆਦਾ ਜਾਇਦਾਦ ਮਾਲਕ ਹਾਂ ਮੈਂ ਆਪਣਾ ਪੂਰਾ ਕਾਨੂੰਨੀ ਨਾਮ ਅਤੇ ਮੌਜੂਦਾ ਸੰਪਰਕ ਜਾਣਕਾਰੀ ਵੀ ਪ੍ਰਦਾਨ ਕਰਾਂਗਾ ਜਿਸ ਵਿੱਚ ਮੇਰਾ ਫੋਨ ਨੰਬਰ ਈਮੇਲ ਪਤਾ ਸ਼ਾਮਿਲ ਹੈ ਜਾਣਕਾਰੀ ਦੀ ਜਾਇਦਾਦ ਦੀ ਜਾਣਕਾਰੀ ਦੇਵਾਂਗਾ ਰਿਹਾਇਸ਼ ਦਾ ਸਬੂਤ ਅਤੇ ਬਿਲਿੰਗ ਅਪਡੇਟ ਲਈ ਬੇਨਤੀ ਕਰਾਂਗਾ